ਮੇਰੇ ਬਾਗ਼ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪੇੜ ਅਤੇ ਪੌਦੇ ਲਗਾਏ ਹੋਏ ਹਨ ਜੋ ਕਿ ਵੱਖ ਵੱਖ ਤਰ੍ਹਾਂ ਦੀਆਂ ਫਲ ਅਤੇ ਸਬਜ਼ੀਆਂ ਦਿੰਦੇ ਹਨ ਇਹਨਾਂ ਪੇੜ ਪੌਦਿਆਂ ਦੀ ਪੈਦਾਵਾਰ ਵਧਾਉਣ ਲਈ ਅਤੇ ਇਹਨਾਂ ਨੂੰ ਹਾਨੀਕਾਰਕ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਕਾਫ਼ੀ ਤਰੀਕੇ ਵਰਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਤਰੀਕਾ ਮਲਚਿੰਗ ਜਾਂ ਮਲਚ ਹੈ ਇਸ ਤਰੀਕੇ ਦੇ ਵਿੱਚ ਸੁੱਕੇ ਪੱਤੇ ਅਤੇ ਰੂੜੀ ਦੀ ਖਾਦ ਨੂੰ ਪੌਦੇ ਦੇ ਆਲੇ ਦੁਆਲੇ ਖਿਲਾਰ ਦਿੱਤਾ ਜਾਂਦਾ ਹੈ ਜਿਸ ਨਾਲ ਪੌਦਾ ਗਰਮੀ ਤੋਂ ਵੀ ਬਚਿਆ ਰਹਿੰਦਾ ਹੈ ਅਤੇ ਦੂਸਰਾ ਉਸਦੀ ਪੈਦਾਵਾਰ ਵੀ ਬਹੁਤ ਵੱਧਦੀ ਹੈ ਤੀਸਰਾ ਪੌਦੇ ਨੂੰ ਹਾਨੀਕਾਰਕ ਕੀੜੇ ਮਕੌੜਿਆਂ ਨਾਲ ਲੜਨ ਦੀ ਵੀ ਤਾਕਤ ਮਿਲਦੀ ਹੈ ਇਸ ਤਰੀਕੇ ਦੇ ਨਾਲ ਪੈਦਾਵਾਰ ਦੇ ਵਿੱਚ ਇੰਕਰੀਜ ਵੀ ਦੇਖਿਆ ਗਿਆ ਹੈ ਇਸ ਤੋਂ ਬਿਨਾਂ ਵੀ ਕਈ ਤਰੀਕੇ ਹਨ ਜੋ ਕਿ ਵਰਤੇ ਜਾ ਵਰਤੇ ਜਾ ਸਕਦੇ ਹਨ ਕਿਸੇ ਵੀ ਪੌਦੇ ਦੀ ਪੈਦਾਵਾਰ ਵਧਾਉਣ ਲਈ ਜਾਂ ਉਸ ਨੂੰ ਕਿਸੇ ਵੀ ਬਿਮਾਰੀ ਤੋਂ ਬਚਾਉਣ ਲਈ ਜਿਸ ਵਿੱਚੋਂ ਇੱਕ ਤਰੀਕੇ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜੋ ਆਪਣੇ ਘਰ ਦੇ ਵਿੱਚ ਲੱਸੀ ਹੁੰਦੀ ਹੈ ਜੇਕਰ ਉਹ ਪੁਰਾਣੀ ਹੋ ਜਾਵੇ ਜਾਂ ਖੱਟੀ ਹੋ ਜਾਵੇ ਜਾਂ ਉਸ ਨੂੰ ਚਾਰ ਪੰਜ ਦਿਨ ਰੱਖ ਕੇ ਪੌਦੇ ਦੇ ਉੱਤੇ ਪਾ ਦਿੱਤਾ ਜਾਂਦਾ ਹੈ ਜਿਸ ਨਾਲ ਪੌਦੇ ਨੂੰ ਕਾਫ਼ੀ ਤਾਕਤ ਮਿਲਦੀ ਹੈ ਅਤੇ ਪੌਦੇ ਦੀ ਪੈਦਾਵਾਰ ਦੇ ਵਿੱਚ ਇੰਕਰੀਜ ਵੀ ਦੇਖਿਆ ਜਾਂਦਾ ਹੈ